ਸਤਿ ਸ਼੍ਰੀ ਅਕਾਲ ਜੀ ਇਤਿਹਾਸਿਕ ਸਥਾਨਾਂ ਵਿੱਚੋਂ ਜਿਹੜਾ ਆ ਸਭ ਤੋਂ ਪ੍ਰਮੁੱਖ ਸਥਾਨ ਤਾਂ ਦਰ ਦਰਬਾਰ ਸਾਹਿਬ ਹੀ ਆਉਂਦਾ ਆ ਦਰਬਾਰ ਸਾਹਿਬ ਦਾ ਇਤਿਹਾਸ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪਹਿਲਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਆ ਜਿਹੜੀ ਉਹ ਹਰਿਮੰਦਰ ਸਾਹਿਬ ਹੋਈ ਹੈ ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਸਾਡਾ ਹੈਗਾ ਵਾ ਹਰਿਮੰਦਰ ਸਾਹਿਬ ਇਹਦੀ ਜਿਹੜੀ ਹੈਗੀ ਆ ਨੀਂਹ ਪੱਥਰ ਇਹ ਗੁਰੂ ਨਾਨਕ ਦੇਵ ਜੀ ਨੇ ਰਖਵਾਇਆ ਖੁਦ

ਸਾਡਾ ਦੇਖਣਾ ਚਾਹੀਦਾ ਆ ਦੇਖਣਯੋਗ ਹੈ ਉਹ ਫਿਰ ਸਾਡਾ ਵਾਹਗਾ ਬੋਰਡਰ ਉੱਥੇ ਦੀ ਜਿਹੜੀ ਪਰੇਡ ਆ ਉੱਥੋਂ ਦੀ ਦੇਖਣ ਵਾਲੀ ਪਰੇਡ ਆ ਕੀ ਪਰੇਡ ਆ ਉਸ ਤੋਂ ਬਾਅਦ ਫਿਰ ਸੀਤਲਾ ਜੀ ਮੰਦਰ ਆ ਹੋਰ ਵੀ ਬਹੁਤ ਸਾਰੇ ਸਥਾਨ ਹੈਗੇ ਆ ਦੁਰਗਿਆਨਾ ਮੰਦਰ ਆ ਅਤੇ ਬਹੁਤ ਸਾਰੇ ਸਥਾਨ ਆ ਜਿਹੜੇ ਮਤਲਬ ਕਿ ਆਪਣੇ ਆਪ ਵਿੱਚ ਕੁਛ ਨਾ ਕੁਛ ਦਰਸਾਉਂਦੇ ਆ ਵਿੱਚ ਛੇਹਰਟਾ ਸਾਹਿਬ ਜਿਹੜਾ ਛੇਹਰਟਾ ਸਾਹਿਬ ਜੀ ਆ ਉਹ ਬਾਬਾ ਜੀ ਉੱਥੇ ਖੇਡਦੇ ਹੁੰਦੇ ਸੀਗੇ ਉੱਥੇ ਉਹਨਾਂ ਦਾ ਛੇਵੇਂ ਪਾਤਸ਼ਾਹ ਜੀ ਦਾ ਜਨਮ ਹੋਇਆ ਵਾ ਅਤੇ ਬਹੁਤ ਵਧੀਆ ਮੈਂ ਕਹਿੰਦੀ ਬਣਿਆ ਹੋਇਆ ਵਾ ਅਤੇ ਉਹ ਵੀ ਦੇਖਣਯੋਗ ਆ